ਮੈਂ ਸਟੈਂਪਾਂ ਤਾਂ ਇਕੱਠੀਆਂ ਨਹੀਂ ਕਰਦਾ ਪਰੰਤੂ ਮੈਂ ਕੁਝ ਸਿੱਕੇ ਘਰ ਵਿੱਚ ਰੱਖੇ ਹਨ ਯਾਦਗਾਰ ਦੇ ਵਜੋਂ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਕਿ ਅਜਿਹੇ ਸਿੱਕੇ ਵੀ ਸਾਡੇ ਜ਼ਮਾਨੇ ਦੇ ਵਿੱਚ ਪ੍ਰਚਲਿਤ ਸਨ